ਭੰਗੜਾ ਪੰਜਾਬ ਦੇ ਦੋ ਮੁੱਖ ਤੇ ਉਗੇ ਲੋਕ ਨਾਚ ਵਿੱਚ ਇੱਕ ਹੈ ਦੂਜਾ ਮੁੱਖ ਨਾਚ ਗਿੱਧਾ ਹੈ ਭੰਗ ਭੰਗੜਾ ਗੱਭਰੂਆਂ ਦੇ ਨਾਚ ਹੈ ਜਦ ਕਿ ਗਿਧਾ ਮੁਟਿਆਰਾ ਦਾ ਭੰਗੜ ਤਕਰੀਬਨ ਹਰ ਖੁਸ਼ੀ ਦੇ ਮੌਕੇ ਤੇ ਆਇਆ ਜਾਂ ਨੱਚਾ ਜਾਂਦਾ ਹੈ ਜਿਨਾਂ ਵਿੱਚ ਕਣਕ ਦੀ ਬਾਡੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਤੇ ਤਿਉਹਾਰ ਆਦਿ ਸ਼ਾਮਿਲ ਆ ਇਹ ਲੋਕ ਨਾਚ ਪੰਜਾਬ ਦੇ ਕਿਸਾਨ ਨੇ ਸੰਸਕ੍ਰਿਤਿਕ ਜਿੰਨਾ ਇਹ ਪਹਿਚਾਣ ਹੈ ਭੰਗੜਾ ਬਹੁਤ ਤਰ੍ਹਾਂ ਦਾ ਹੈ ਜੀਵੇ ਝੂਮਰ ਸੰਮੀ ਲੁੱਡੀ ਭੰਗੜਾ ਪੰਜਾਬੀ ਆਦਿ ਕੌਮੀ ਨਾਚ ਹੋਣ ਦਾ ਮਾਣ ਰੱਖਦਾ ਇਹ ਪੁਰਸ਼ਾਂ ਦਾ ਇਕੋ ਇਕ ਅਜਿਹਾ ਨਾਚ ਹੈ ਜਿਸ ਨੂੰ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੰਚਾ ਉਤੇ ਪੰਜਾਬ ਦੀ ਪੁਰਸ਼ਾਂ ਨਾਚ ਵਜੋਂ ਪ੍ਰਵਾਨ ਕੀਤਾ ਗਿਆ ਭੰਗੜੇ ਦੇ ਆਰੰਭ ਵਿੱਚ ਡੋਲੀ ਵਿਸ਼ੇਸ਼ ਕਿਸਮ ਦੇ ਤਾੜ ਨਾਲ ਭੰਗੜੇ ਵਾਲੇ ਗੱਭਰੂਆਂ ਨੂੰ ਸੱਦਦਾ ਹੈ ਬੋਲੀਆਂ ਬਿਨਾਂ ਭੰਗੜੇ ਅਧੂਰ ਸਮਝਿਆ ਜਾਂਦਾ ਹੈ ਭੰਗੜਾ ਪਹਿਲਾ ਪੱਛਮੀ ਪੰਜਾਬ ਦੇ ਜਿਲੇ ਸ਼ੇਖਪੁਰ ਪੱਛਮੀ ਗੁਰਜਰਾਤ ਅਤੇ ਸਿਆਲਕੋਟ ਵਿੱਚ ਜਿਆਦਾ ਪ੍ਰਚਲਿਤ ਹੈ ਭੰਗੜੇ ਵਿੱਚ ਪੇਂਡੂ ਸਾਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਢੋਲ ਭੰਗੜੇ ਆਦ ਦਾ ਮੁੱਖ ਸਾਜ ਹੈ ਭਾਂਗੜੇ ਵਿੱਚ ਢੋਲੀ ਮਹੱਤਵ ਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜਾ ਗੱਭਰੂ ਮੁਟਿਆਰਾਂ ਬਲਕਿ ਸਭ ਦੀ ਜਾਨ ਹੁੰਦੀ ਹੈ ਭੰਗੜੇ ਵਿੱਚ ਮੁੰਡੇ ਗੱਬਰੂ ਸੱਜ ਧੱਜ ਕੇ ਆਉਂਦੇ ਹਨ ਕੁੜਤੇ ਚਾਦਰੇ ਪਾ ਕੇ ਕੈਂਠੇ ਪਾ ਕੇ ਪਹਿਰੇ ਜੁੱਤੀ ਪਾ ਕੇ ਆਉਂਦੇ ਸਨ ਤੇ ਇੱਕ ਮੁਟਿਆਰਾਂ ਇਸ ਭੰਗੜੇ ਵਿੱਚ ਬਹੁਤ ਧੂਮ ਧਾਮ ਨਾਲ ਨੱਚਦੀਆਂ ਹਨ ਗਾਉਂਦੀਆਂ ਹਨ ਉਹਨਾਂ ਨੂੰ ਇਸ ਗਿੱਧੇ ਦਾ ਬਹੁਤ ਇਨਜਰ ਹੁੰਦਾ ਹੈ ਮੁੰਡੇ ਗਬਰੂ ਇਹ ਭੰਗੜੇ ਵਿੱਚ ਬਹੁਤ ਧਮਾਲਾ ਪਾਉਂਦੇ ਨੇ ਗਿੱਧੇ ਵਿੱਚ ਧਮਾਲਾ ਪੈਂਦੀਆਂ ਨੇ ਇਹ ਪੰਜਾਬੀਆਂ ਦਾ ਬਹੁਤ ਮੁੱਖ ਨਾਚ ਹੈਗਾ ਤੇ